ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਵੀਰ ਜੀ ਦਿੱਲੀ ਤੋਂ ਬੋਲਦੀ ਹਾਂ ਮੈਨੂੰ ਤੁਹਾਡਾ ਨੰਬਰ ਸਾਡੇ ਇੱਕ ਰਿਸ਼ਤੇਦਾਰ ਨੇ ਉਹਨਾਂ ਨੇ ਦਿੱਤਾ ਸੀਗਾ ਅਸੀਂ ਦਰਅਸਲ ਨਾ ਸ਼ਹੀਦੀ ਜੋੜ ਮੇਲੇ 'ਤੇ ਦਰਸ਼ਨਾਂ ਨੂੰ ਆਉਣਾ ਚਾਹੁੰਦੇ ਸੀਗੇ ਪਰ ਹੁਣ ਦੇਖਦੇ ਹਾਂ ਅਖ਼ਬਾਰਾਂ ਵਗੈਰਾ 'ਚ ਵੀ ਵੀ ਭੀੜ ਬਹੁਤ ਆ ਇੱਥੇ ਪਰ ਮੈਂ ਤੁਹਾਡੇ ਤੋਂ ਸਲਾਹ ਲੈਣਾ ਚਾਹੁੰਦੀ ਸੀ ਵੀ ਅਸੀਂ ਕਦੋਂ ਆਈਏ ਕਿੱਧਰ ਨੂੰ ਆਈਏ ਨਾਲ਼ੇ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਹਮ ਹਮ ਅੱਛਾ ਜੀ ਅੱਛਾ ਜੀ ਅਤੇ ਪਾਰਕਿੰਗ ਵਗੈਰਾ ਲਈ ਕਿਧਰੇ ਜਗ੍ਹਾ ਹੁੰਦੀ ਹੈ ਜਾਂ ਕਿੱਧਰ ਨੂੰ ਆਈਏ ਅਸੀਂ

ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਜੀ ਠੀਕ ਹੈ ਅੱਛਾ ਜੀ ਠੀਕ ਹੈ ਅਤੇ ਹੋਰ ਕਿਹੜੇ ਨੇੜੇ ਨੇੜੇ ਹੋਰ ਗੁਰਦੁਆਰੇ ਕਿਹੜੇ ਨੇ ਜਿੱਥੇ ਦਰਸ਼ਨ ਕੀਤੇ ਜਾ ਸਕਦੇ ਨੇ

ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਵੀਰ ਜੀ ਸ਼ੁਕਰੀਆ ਮੈਨੂੰ ਜੇ ਲੋੜ ਪਈ ਅਸੀਂ ਆ ਕੇ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਕੋਲ ਕਰੀਏ ਜੇ ਪਤਾ ਲ ਨਾ ਲੱਗਿਆ ਕੁਛ ਤਾਂ ਅਸੀਂ ਤੁਹਾਨੂੰ ਫਿਰ ਖੇਚਲ਼ ਦੇਵਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ